ਅੱਜ ਕੱਲ੍ਹ ਭਾਰਤ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਿਆ ਹੈ ਆਜ਼ਾਦੀ ਤੋਂ ਬਾਅਦ ਆਰਥਿਕ ਤੰਗੀ ਤੋਂ ਬਾਅਦ ਭਾਰਤ ਬਹੁਤ ਉੱਪਰ ਉੱਠ ਚੁੱਕਾ ਹੈ ਅਤੇ ਹੁਣ ਅੱਜ ਕੱਲ੍ਹ ਭਾਰਤ ਵਿੱਚ ਆਵਾਜਾਈ ਵੀ ਬਹੁਤ ਵੱਧ ਚੁੱਕੀ ਹੈ ਟੂਰਿਜ਼ਮ ਨੂੰ ਭਾਰਤ ਵਿੱਚ ਕਾਫੀ ਬੜਾ ਵਧਾਇਆ ਜਾ ਰਿਹਾ ਹੈ ਜਿਵੇਂ ਕਿ ਭਾਰਤ ਵਿੱਚ ਪਹਾੜ ਘੁੰਮਣ ਲਈ ਸਭ ਤੋਂ ਵਧੀਆ ਜਗ੍ਹਾ ਹਿਮਾਚਲ ਅਤੇ ਨੌਰਥ ਈਸਟ ਹੈ ਭਾਰਤ ਵਿੱਚ ਸਮੁੰਦਰ ਦੇਖਣ ਲਈ ਤੁਸੀਂ ਗੋਆ ਜਾ ਸਕਦੇ ਹੋ ਅਤੇ ਗੋਆ ਦਾ ਮੌਸਮ ਬਹੁਤ ਸੋਹਣਾ ਹੈ ਜੇ ਤੁਸੀਂ ਤੀਰਥ ਘੁੰਮਣਾ ਚਾਹੁੰਦੇ ਹੋ ਤਾਂ ਤੀਰਥ ਤਾਂ ਪੰਜਾਬ ਹੋ ਗਿਆ ਪੰਜਾਬ ਵਿੱਚ ਅੰਮ੍ਰਿਤਸਰ ਅਤੇ ਉੜੀਸਾ ਜਾ ਸਕਦੇ ਹੋ ਜਿੱਥੇ ਮੰਦਰ ਹੀ ਮੰਦਰ ਹਨ ਪੁਰੀ ਜਗਨਨਾਥ ਬਹੁਤ ਹੀ ਧਾਰਮਿਕ ਅਤੇ ਬਹੁਤ ਹੀ ਸੋਹਣੀ ਜਗ੍ਹਾ ਹੈ ਇਸ ਤੋਂ ਇਲਾਵਾ ਤੁਸੀਂ ਵਰਿੰਦਾਵਨ ਯਾਨੀ ਕਿ ਉੱਤਰ ਪ੍ਰਦੇਸ਼ ਵਿੱਚ ਵੀ ਜਾ ਸਕਦੇ ਹੋ ਜੋ ਕਿ ਰਾਮ ਨਗਰੀ ਹੈ ਅਤੇ ਤੁਸੀਂ ਅੱਜ ਕੱਲ੍ਹ ਨਵਾਂ ਉਸਾਰਿਆ ਰਾਮ ਮੰਦਰ ਵਿੱਚ ਵੀ ਜਾ ਕੇ ਆਪਣੇ ਨਤਮਸਤਕ ਹੋ ਸਕਦੇ ਹੋ ਟੂਰਿਜ਼ਮ ਭਾਰਤ ਵਿੱਚ ਕਾਫੀ ਜ਼ਿਆਦਾ ਵੱਧ ਚੁੱਕਾ ਪਰ ਇਸਨੂੰ ਦੇਖਣ ਲਈ ਕਾਫੀ ਚੁਣੌਤੀਆਂ ਵੀ ਫੇਸ ਕਰਨੀਆਂ ਪੈਂਦੀਆਂ ਹਨ ਜਿੱਦਾਂ ਕਿ ਇੱਕ ਚੁਣੌਤੀ ਜੋ ਭਾਰਤ ਸਾਹਮਣੇ ਆ ਰਹੀ ਹੈ ਉਹ ਹੈ ਰੇਲਵੇ ਰੇਲਵੇ ਵਿੱਚ ਸਾਫ ਸਫਾਈ ਰੱਖਣੀ ਬਹੁਤ ਮੁਸ਼ਕਿਲ ਹੋ ਰਹੀ ਹੈ ਟਰੇ ਟ੍ਰੇਨਾਂ ਚੱਲਦੀਆਂ ਤਾਂ ਹਨ ਪਰ ਜ਼ਿਆਦਾਤਰ ਟਾਇਮ ਲੇਟ ਹੁੰਦੀਆਂ ਹਨ ਅਤੇ ਉਹ ਟ੍ਰੇਨਾਂ ਵਿੱਚ ਸਾਫ ਸਫਾਈ ਵੀ ਨਹੀਂ ਜ਼ਿਆਦਾਤਰ ਹੁੰਦੀ ਬਹੁਤ ਹੀ ਜ਼ਿਆਦਾ ਅਮੀਰ ਟਰੇਨਾਂ ਜਿੱਦਾਂ ਕਿ ਰਾਜਧਾਨੀ ਸ਼ਤਾਬਦੀ ਇਹਨਾਂ ਵਿੱਚ ਹੀ ਤੁਹਾਨੂੰ ਕਾਫੀ ਵਧੀਆਂ ਮਿਲਦਾ ਹੈ ਅਤੇ ਆਮ ਜਨਤਕ ਟਰੇਨਾਂ ਵਿੱਚ ਇੰਨੀ ਸਾਫ ਸਫਾਈ ਨਹੀਂ ਮਿਲਦੀ ਹੈ ਉਤੋਂ ਟਿਕਟ ਤਾਂ ਜੈਨੂਅਨ ਰੇਟ 'ਤੇ ਹੀ ਮਿਲ ਜਾਂਦੀ ਹੈ ਬਟ ਇਹਨਾਂ ਵਿੱਚ ਦਿੱਕਤ ਇਹੀ ਆਉਂਦੀ ਹੈ ਕਿ ਸਾਫ ਸਫਾਈ ਦੀ ਕਮੀ ਹੁੰਦੀ ਹੈ ਅਤੇ ਟ੍ਰੇਨ ਬਹੁਤ ਲੇਟ ਹੁੰਦੀ ਹੈ ਜਿਸ ਕਾਰਨ ਕਿ ਬੰਦਾ ਟਾਈਮ ਸਿਰ ਆਪਣੀ ਜਗ੍ਹਾ 'ਤੇ ਨਹੀਂ ਪਹੁੰਚ ਪਾਉਂਦਾ ਹੋਰ ਟਰੇਨ ਭਾਰਤ ਵਿੱਚ ਆਉਣ ਜਾਣ ਦਾ ਸਾਧਨ ਹੈ ਜੋ ਕਿ ਸੜਕਾਂ ਦਾ ਹੈ ਸੜਕਾਂ ਵਿੱਚ ਵੀ ਭਾਰਤ ਵਿੱਚ ਨੈਸ਼ਨਲ ਹਾਈਵੇ ਤਿਆਰ ਕੀਤੇ ਗਏ ਹਨ ਨੈਸ਼ਨਲ ਹਾਈਵੇ ਉੱਦਾਂ ਤਾਂ ਬਹੁਤ ਵਧੀਆ ਅਤੇ ਕਾਫੀ ਜ਼ਿਆਦਾ ਸਹੀ ਬਣਾਏ ਗਏ ਹਨ ਪਰ ਹੋਰ ਇਸ ਦੇ ਵਿੱਚ ਜੋ ਦਿੱਕਤ ਆ ਰਹੀ ਹੈ ਉਹ ਹੈ ਟੋਇਆਂ ਟਿੱਬਿਆਂ ਅਤੇ ਮਾੜਾ ਵਿੱਚ ਮਟੀਰੀਅਲ ਯੂਜ ਕਰਨਾ ਟੋਏ ਟਿੱਬੇ ਇੰਨੇ ਆ ਜਾਂਦੇ ਹਨ ਕਿ ਭਾਰਤ ਵਿੱਚ ਕਾਫੀ ਜ਼ਿਆਦਾ ਰੋਡ ਐਕਸੀਡੈਂਟ ਤਾਂ ਸੜਕ ਕਰਕੇ ਹੀ ਹੋ ਜਾਂਦੇ ਹਨ ਸੜਕ ਪ੍ਰੋਪਰ ਨਾ ਹੋਣੀ ਜਾਂ ਟੁੱਟੀ ਹੋਈ ਹੋਣ ਕਰਕੇ ਹੀ ਕਾਫੀ ਜ਼ਿਆਦਾ ਦਿੱਕਤਾਂ ਆ ਜਾਂਦੀਆਂ ਹਨ ਤਾਂ ਅੱਜ ਦੇ ਤਾਂ ਅੱਜ ਦੇ ਸਮੇਂ ਵਿੱਚ ਭਾਰਤ ਨੇ ਬਹੁਤ ਚੁਣੌਤੀਆਂ ਨੂੰ ਅੰਜਾਮ ਦਿੱਤਾ ਹੈ ਜਿੱਥੇ ਕਿ ਜ਼ਿਆਦਾਤਰ ਐਕਸੀਡੈਂਟ ਦਾ ਕਾਰਨ ਸੜਕ ਦਾ ਖਰਾਬ ਹੋਣਾ ਹੀ ਹੁੰਦਾ ਹੈ ਸੀ ਇਸ ਤੋਂ ਬਾਅਦ ਦੇਖਿਆ ਜਾਏ ਤਾਂ ਭਾਰਤ ਦੀ ਹਵਾਈ ਯਾਤਰਾ ਆ ਗਈ ਹੈ ਜਿਸ ਵਿੱਚ ਕਿ ਏਅਰ ਇੰਡੀਆ ਅਤੇ ਹੋਰਨਾਂ ਔਫ ਹਵਾ ਹਵਾਈ ਜਹਾਜਾਂ ਦੀ ਵੀ ਵਰਤੋਂ ਹੁੰਦੀ ਹੈ ਏਅਰ ਇੰਡੀਆ ਭਾਰਤ ਦੀ ਸਰਕਾਰੀ ਕੰਪਨੀ ਹੈ ਜੋ ਕਿ ਹੁਣ ਟਾਟਾ ਨੂੰ ਵਿਕ ਚੁੱਕੀ ਹੈ ਇਹ ਕੰਪਨੀ ਪਹਿਲਾਂ ਟਾਟਾ ਕੋਲ ਹੀ ਹੁੰਦੀ ਸੀ ਉਸ ਤੋਂ ਬਾਅਦ ਸਰਕਾਰ ਨੇ ਆਪਣੇ ਹੱਥ ਲਿੱਤੀ ਅਤੇ ਉਸ ਤੋਂ ਬਾਅਦ ਹੁਣ ਫਿਰ ਇਹ ਟਾਟਾ ਕੋਲ ਹੀ ਜਾ ਚੁੱਕੀ ਹੈ ਇਹਨਾਂ ਵਿੱਚ ਹੁਣ ਜਹਾਜੀ ਸਫਰਾਂ ਵਿੱਚ ਕੋਈ ਖਾਸ ਦਿੱਕਤ ਨਹੀਂ ਹੁੰਦੀ ਪਰ ਜੋ ਇੱਕ ਦਿੱਕਤ ਸਭ ਤੋਂ ਵੱਡੀ ਸਾਹਮਣੇ ਆਉਂਦੀ ਹੈ ਉਹ ਹੈ ਜਹਾਜ ਦਾ ਲੇਟ ਹੋਣਾ ਬੋਡਿੰਗ ਲੇਟ ਹੋਣੀ ਅਤੇ ਆਪਣੇ ਨਿਰਧਾਰਿਤ ਸਮੇਂ ਤੋਂ ਨਹੀਂ ਚੱਲਣਾ ਅਤੇ ਜ਼ਿਆਦਾਤਰ ਦਿੱਕਤ ਆਉਂਦੀ ਹੈ ਜਾ ਕੇ ਏਅਰਪੋਰਟ ਵਿੱਚ ਕਤਾਰਾਂ ਵਿੱਚ ਲੱਗਣ ਦੀ ਅਤੇ ਇੰਨਾਂ ਚਿਰ ਖੜ੍ਹ ਕੇ ਉਡੀਕਣਾ ਬ ਬਾਕੀ ਤਾਂ ਭਾਰਤ ਵਿੱਚ ਕੋਈ ਦਿੱਕਤ ਨਹੀਂ ਹੈ ਬਾਕੀ ਸਭ ਕੁਛ ਬਹੁਤ ਵਧੀਆ ਚਲਦਾ ਹੈ ਅਤੇ ਟੂਰਿਜ਼ਮ ਦੀ ਪ੍ਰਣਾਲੀ ਵੀ ਭਾਰਤ ਵਿੱਚ ਬੜੀ ਜ਼ਿਆਦਾ ਵੱਧ ਚੁੱਕੀ ਹੈ